ਸਾਡੇ ਜ਼ਿਲ੍ਹੇ ਤਰਨ ਤਾਰਨ ਸਾਹਿਬ ਵਿਖੇ ਕਈ ਪੂਜਾ ਦੇ ਸਥਾਨ ਹਨ ਜਿਵੇਂ ਸ਼੍ਰੀ ਦਰਬਾਰ ਸਾਹਿਬ ਬਾਬਾ ਬੁੱਢਾ ਸਾਹਿਬ ਚਿੰਤਪੁਰਨੀ ਮੰਦਰ ਮਦ ਮਤਾ ਮੋਹਨ ਠਾਕੁਰ ਦੁਆਰਾ ਮੰਦਰ ਸਾ ਮਾਤਾ ਕੋਲਾਂ ਦੇਵੀ ਜੀ ਦਾ ਮੰਦਰ ਅਤੇ ਆਦਿ